ਤਕਨੋਲਜੀ ਨੇ ਨਿਊਜ਼ ਇੰਡਸਟਰੀ ਵਿੱਚ ਬਹੁਤ ਮਦਦ ਕੀਤੀ ਹੈ ਜਿਵੇਂ ਕਿ ਪਹਿਲਾਂ ਦੇ ਯੁੱਗ ਵਿੱਚ ਅਸੀਂ ਦੇਖਦੇ ਸੀਗੇ ਨਿਊਜ਼ ਜਿਹੜੀ ਆਉਂਦੀ ਸੀ ਜਾਂ ਨਿਊਜ਼ ਪੇਪਰ ਰਾਹੀਂ ਰੇਡੀਓਸ ਜਾਂ ਟੈਲੀਵਿਜ਼ਨ ਰਾਹੀਂ ਆਉਂਦੀ ਸੀ ਜਿਸ ਨੂੰ ਆਉਣ ਤਾਂਈ ਬਣਨ ਤਾਂਈ ਬਹੁਤ ਟਾਈਮ ਲੱਗਦਾ ਸੀ ਲੇਕਿਨ ਅੱਜ ਕੱਲ੍ਹ ਦੇ ਚੈਨਲਸ ਨੇ ਜੋ ਸੈਟਾਲਾਈਟ ਨਾਲ਼ ਲਾਈਵ ਚੱਲਦੇ ਨੇ ਕਿ ਜਿਹੜੀ ਘਟਨਾ ਕਿਤੇ ਵੀ ਹੋ ਰਹੀ ਹੋਵੇ ਉਸ ਨੂੰ ਲਾਈਵ ਦਿਖਾਇਆ ਜਾਂਦਾ ਹੈ ਅਤੇ ਜਿਹੜੀ ਨਿਊਜ਼ ਹੈ ਉਹ ਨਾਲ਼ੋਂ ਨਾਲ਼ ਬੰਦੇ ਕੋਲ ਪਹੁੰਚ ਜਾਂਦੀ ਹੈ ਕਿ ਕਿੱਥੇ ਕਿਆ ਘਟਨਾ ਹੋਈ ਹੈ ਕਿੱਥੇ ਕਿਆ ਨਵਾਂ ਹੋਣ ਜਾ ਰਿਹਾ ਹੈ ਅਤੇ ਦੇਸ਼ ਵਿੱਚ ਕਿਆ ਕਿਆ ਹੋ ਰਿਹਾ ਹੈ ਉਸ ਦੀ ਨਿਊਜ਼ ਤੁਹਾਨੂੰ ਵੇਟ ਨਹੀਂ ਕਰਨਾ ਪੈਂਦਾ ਸਮਾਂ ਕਿ ਨਾਲੋਂ ਨਾਲ਼ ਹੀ ਤੁਹਾਨੂੰ ਮਿਲ ਜਾਂਦੀ ਹੈ